ਮੌਜੂਦਾ ਦ੍ਰਿਸ਼ ਵਿੱਚ ਵਿਗਿਆਪਨ ਅਤੇ ਵਧੇਰੇ ਲੋਕਾਂ ਤੱਕ ਪਹੁੰਚਣ ਦੇ ਕੁਝ ਤਰੀਕੇ ਹਨ ਜਿਵੇਂ ਕਿ ਮੀਡੀਆ ਅੱਜ ਕੱਲ੍ਹ ਬਹੁਤ ਐਡਵਾਂਸ ਹੈ ਅਤੇ ਹਰ ਕੋਈ ਹਰ ਕੋਈ ਕੰਪਨੀ ਚਾਹੁੰਦੀ ਹੈ ਕਿ ਉਸਦਾ ਉਸਦੇ ਉਸਦੇ ਮਾਲ ਦੀ ਖਰੀਦੋ ਫਰੋਖਤ ਹੋਵੇ ਅਤੇ ਉਸ ਲਈ ਉਹ ਆਪਣਾ ਐਡਵਰਟਾਈਜਮੈਂਟ ਚੈਨਲਾਂ ਨੂੰ ਦਿੰਦੀ ਹੈ ਅਤੇ ਚੈਨਲ ਉਹ ਇਸ ਨੂੰ ਦਿਖਾਉਂਦੇ ਹਨ ਇਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਵੀ ਜੋ ਉਹ ਲੋਕ ਭਲਾਈ ਸਕੀਮਾਂ ਸ਼ੁਰੂ ਕਰਦੀਆਂ ਹਨ ਉਨ੍ਹਾਂ ਨੂੰ ਚੈਨਲਾਂ 'ਤੇ ਵਿਖਾਉਂਦੀਆਂ ਹਨ ਤਾਂ ਕਿ ਲੋਕਾਂ ਨੂੰ ਇਹਨਾਂ ਬਾਰੇ ਜਾਣਕਾਰੀ ਹੋ ਸਕੇ ਅਤੇ ਉਹ ਇਸ ਦਾ ਫਾਇਦਾ ਉਠਾ ਸਕਣ ਧੰਨਵਾਦ